ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਹਾਂਜੀ ਸਾਡੇ ਬਜ਼ੁਰਗ ਤਾਂ ਪਹਿਲਾਂ ਐਨ ਠੀਕ ਠਾਕ ਸੀ ਜੀ ਹੁਣ ਨਾ ਮੰਜੇ 'ਤੇ ਪੈ ਗਏ ਜਮੀ ਢਿੱਲੇ ਹੈ ਜੀ ਹਾਂਜੀ ਉਹਦਾ ਕਾਰਨ ਹੈ ਜੀ ਇੱਕ ਤਾਂ ਏਜ਼ ਜ਼ਿਆਦਾ ਹੋ ਗਈ ਜੀ ਅਤੇ ਸਪਰੇਹਾਂ ਸਪਰੂਹਾਂ ਬਹੁਤ ਹੁੰਦੀਆਂ ਜੀ ਮਿਲਾਵਟੀ ਦੁੱਧ ਦੇਖ ਲਉ ਜੀ ਸਬਜ਼ੀਆਂ ਦੇਖ ਲਉ ਜਿਹੜੀ ਮਰਜ਼ੀ ਚੀਜ਼ ਦੇਖ ਲਉ ਜੀ ਦੇਖੋ ਕਾਰਨ ਬਿਮਾਰੀ ਦੇ ਇਹੀ ਨੇ ਅਤੇ ਇਨ੍ਹਾਂ ਨੂੰ ਇਨ੍ਹਾਂ ਕਰਕੇ ਹੀ ਬਾਪੂ ਜੀ ਮੰਜੇ 'ਤੇ ਪਏ ਨੇ ਜੀ ਹਾਂਜੀ ਅਤੇ ਇਹਨਾਂ ਦੀ ਦੇਖਭਾਲ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ ਜੀ ਅਤੇ ਰੋਜ਼ ਨਵਾਉਂਦੇ ਹਾਂ ਜੀ ਅਤੇ ਮੈਡੀਸਨ ਟਾਈਮ ਨਾਲ ਦਿੰਦੇ ਹਾਂ ਜੀ ਚੈੱਕਅਪ ਟਾਈਮ ਨਾਲ ਕਰਵਾਉਂਦੇ ਹਾਂ ਜੀ ਅਤੇ ਅਤੇ ਚਾਹ ਪਾਣੀ ਦੀ ਸੇਵਾ ਐਨ ਵਧੀਆ ਤਰੀਕੇ ਨਾਲ ਕਰਦੇ ਹਾਂ ਜੀ ਟਾਈਮ ਸਿਰ ਇਹਨੂੰ ਇਹਨਾਂ ਨੂੰ ਹਰੇਕ ਚੀਜ਼ ਮਿਲਦੀ ਹੈ ਜੀ ਬੀ ਪੀ ਵਗੈਰਾ ਸਭ ਕੁਛ ਚੈੱਕ ਟਾਈਮ ਨਾਲ ਕਰਵਾਈ ਦਾ ਜੀ ਹਾਂਜੀ ਸਰ ਧੰਨਵਾਦ ਜੀ